ਹਾਂ ਮੈਨੂੰ ਕਈ ਵਾਰ ਪੰਜਾਬੀ ਭਾਸ਼ਾ ਦਾ ਕਈ ਹੋਰ ਭਾਸ਼ਾਵਾਂ ਦੇ ਵਿੱਚ ਅਨੁਵਾਦ ਕਰਨਾ ਪਿਆ ਇਸ ਦੀ ਲੋੜ ਸਾਨੂੰ ਕਿਉਂ ਪਈ ਕਿਉਂਕਿ ਕਈ ਵਾਰ ਇਹ ਆ ਹੁੰਦਾ ਕਿ ਕੁਝ ਸ਼ਬਦ ਸਾਨੂੰ ਪੰਜਾਬੀ ਦੇ ਸਮਝ ਨਹੀਂ ਆਉਂਦੇ ਅਤੇ ਜਿਨ੍ਹਾਂ ਦੇ ਕਰਕੇ ਅਸੀਂ ਇਸਨੂੰ ਹੋਰ ਭਾਸ਼ਾ ਦੇ ਵਿੱਚ ਅਨੁਵਾਦ ਕਰਕੇ ਇਜੀਲੀ ਸਮਝ ਸਕਦੇ ਹਾਂ ਮੈਨੇ ਬਹੁਤ ਸਾਰੇ ਸ਼ਬਦਾਂ ਦਾ ਹਿੰਗ ਇੰਗਲਿਸ਼ ਦੇ ਵਿੱਚ ਅਨੁਵਾਦ ਕੀਤਾ ਹੈ ਅਤੇ ਕਈਆਂ ਦਾ ਹਿੰਦੀ ਵਿੱਚ ਵੀ ਅਨੁਵਾਦ ਕੀਤਾ ਹੈ ਅਤੇ ਇਸ ਨਾਲ ਮੈਨੂੰ ਉਹਨਾਂ ਨੂੰ ਸਮਝਣ ਦੀ ਉਹ ਸਹੂਲਤ ਮਿਲੀ ਹੈ ਕਈ ਵਾਰ ਹੁੰਦਾ ਕਿ ਸਾਡਾ ਏਰੀਆ ਟੂ ਏਰੀਆ ਫਰਕ ਪੈ ਜਾਂਦਾ ਕਿ ਸਾਨੂੰ ਕਈ ਭਾਸ਼ਾਵਾਂ ਕਈ ਪੰਜਾਬੀ ਅੱਖਰ ਹੈ ਜੋ ਸਾਨੂੰ ਏਰੀਆ ਵਾਈਜ ਸਮ ਸਮਝ ਨਹੀਂ ਆਉਂਦੇ ਅਤੇ ਕਿਉਂਕਿ ਸਾਡਾ ਏਰੀਆ ਮਾਲਵਾ ਹੈ ਅਤੇ ਇੱਥੋਂ ਦੀ ਬੋਲੀ ਅਲੱਗ ਹੈ ਮਲਵਈ ਹੈ ਅਤੇ ਹੋਰ ਏਰੀਆ ਦੀ ਬੋਲੀ ਅਲੱਗ ਹੋਣ ਕਰਕੇ ਸਾਨੂੰ ਠੇਠ ਪੰਜਾਬੀ ਪ੍ਰੋਪਰ ਨਹੀਂ ਆਉਂਦੀ ਅਤੇ ਇਹਨਾਂ ਦੇ ਕਰਕੇ ਹੀ ਸਾਨੂੰ ਹੋਰ ਭਾਸ਼ਾਵਾਂ ਦੇ ਵਿੱਚ ਅਨੁਵਾਦ ਕਰਨਾ ਪੈਂਦਾ ਹੈ ਕਈ ਵਾਰ ਮੈਂ ਏਰੀਆ ਟੂ ਏਰੀਆ ਵੀ ਜਾਂਦੀ ਹਾਂ ਤਾਂ ਮੈਨੂੰ ਕਈ ਵਾਰ ਉਹ ਬਹੁਤ ਹੀ ਭ ਲੈਂਗੁਏਜ ਦੇ ਅਕੋਰਡਿੰਗ ਬਹੁਤ ਹੀ ਜ਼ਿਆਦਾ ਉਲਝਣਾ ਪੈਂਦਾ ਹੈ ਜਿਵੇਂ ਕਿ ਕਈ ਲੋਕਾਂ ਨੂੰ ਸਾਡੀ ਪੰਜਾਬੀ ਭਾਸ਼ਾ ਨਹੀਂ ਆਉਂਦੀ ਤਾਂ ਉਹਨਾਂ ਨੂੰ ਆਪਣੀ ਗੱਲਬਾਤ ਸਮਝਾਉਣ ਲਈ ਕਿ ਅਸੀਂ ਕੀ ਕਹਿਣਾ ਚਾਹੁੰਦੇ ਹਾਂ ਸਾਨੂੰ ਉਹਨਾਂ ਨੂੰ ਹਿੰਦੀ ਦੇ ਵਿੱਚ ਜਾਂ ਇੰਗਲਿਸ਼ ਦੇ ਵਿੱਚ ਅਨੁਵਾਦ ਕਰਕੇ ਉਹਨਾਂ ਨੂੰ ਆਪਣੀ ਗੱਲਬਾਤ ਸਮਝਾਉਣੀ ਪੈਂਦੀ ਹੈ ਉਹ ਉਹਨਾਂ ਨਾਲ ਗੱਲਬਾਤ ਕਰਕੇ ਸਾਨੂੰ ਬਹੁਤ ਅੱਛਾ ਲੱਗਦਾ ਹੈ ਅਤੇ ਉਹਨਾਂ ਤਾਂ ਕਿ ਇਸ ਲਈ ਅਸੀਂ ਆਪਣੀ ਗੱਲਬਾਤ ਨੂੰ ਉਹਨਾਂ ਤੱਕ ਪਹੁੰਚਾਉਣ ਲਈ ਅਨੁਵਾਦ ਕਰਦੇ ਹਾਂ ਆਪਣੀ ਪੰਜਾਬੀ ਭਾਸ਼ਾ ਦਾ ਹੋਰ ਭਾਸ਼ਾ ਦੇ ਵਿੱਚ ਇਹਨਾਂ ਦੇ ਨਾਲ ਸਾਡੀ ਜੋ ਕਿ ਉਹਨਾਂ ਦੇ ਵਿੱਚ ਕਮਿਊਨੀਕੇਟ ਵਧੀਆ ਤਰੀਕੇ ਨਾਲ ਹੁੰਦਾ ਅਸੀਂ ਉਹਨਾਂ ਨਾਲ ਸਿੱਧੀ ਗੱਲਬਾਤ ਕਰ ਸਕਦੇ ਹਾਂ ਜੋ ਚੀਜ਼ ਸਾਨੂੰ ਸਮਝ ਨਹੀਂ ਆਉਂਦੀ ਉਹ ਸਾਨੂੰ ਅਸੀਂ ਉਹਨਾਂ ਦੀ ਗੱਲ ਨੂੰ ਪੰਜਾਬੀ ਵਿੱਚ ਵੀ ਅਨੁਵਾਦ ਕਰਕੇ ਸਮਝ ਸਕਦੇ ਹਾਂ ਕਿ ਉਹ ਕੀ ਸਾਨੂੰ ਕੀ ਕਹਿਣਾ ਚਾਹੁੰਦੇ ਹਨ ਅਤੇ ਕੀ ਸਮਝਾਉਣਾ ਚਾਹੁੰਦੇ ਹਨ ਅਸੀਂ ਉਹਨਾਂ ਦੇ ਨਾਲ ਸਿੱਧੀ ਗੱਲਬਾਤ ਕਰ ਸਕਦੇ ਹਾਂ ਇਸ ਨਾਲ ਅਤੇ ਇਹ ਸਾਨੂੰ ਇੱਕ ਦੂਜੇ ਦੀ ਭਾਸ਼ਾ ਸਮਝਣ ਲਈ ਅਤੇ ਇੱਕ ਦੂਜੇ ਦੇ ਨੇੜੇ ਲਿਆਉਣ ਵਿੱਚ ਬਹੁਤ ਹੀ ਜ਼ਿਆਦਾ ਸਹਾਇਤਾ ਕਰਦੀ ਹੈ ਇਸ ਦੇ ਨਾਲ ਸਾਨੂੰ ਸਭ ਕੁਝ ਬਹੁਤ ਵਧੀਆ ਲੱਗਦਾ ਹੈ ਅਤੇ ਮੇਰਾ ਅਨੁਭਵ ਇਸ ਦੇ ਨਾਲ ਬਹੁਤ ਹੀ ਜ਼ਿਆਦਾ ਵਧੀਆ ਰਿਹਾ ਹੈ ਆਪਣੇ ਪਰਸਨਲ ਬਿਹਾਫ 'ਤੇ ਕਹਿਣਾ ਚਾਹੁੰਦੀ ਹਾਂ ਕਿ